ਸਾਡੇ ਖੇਤਰ ਦੇ ਵਿੱਚ ਅਤੇ ਸਮਾਜ ਦੇ ਵਿੱਚ ਕਈ ਕਲਾਵਾਂ ਮਸ਼ਹੂਰ ਹਨ ਜਿਹੜੀਆਂ ਕਿ ਪੁਰਾਣੇ ਸਮਿਆਂ ਤੋਂ ਹੀ ਚੱਲੀਆਂ ਆ ਰਹੀਆਂ ਹਨ ਜਿਵੇਂ ਕਿ ਮੂਰਤੀ ਕਲਾ ਅਤੇ ਅਤੇ ਸਵੈਟਰ ਬੁਣਨਾ ਪੁਰਾਣੇ ਜ਼ਮਾਨੇ ਤੋਂ ਹੀ ਬੁੜੀਆ ਸਵੈਟਰ ਬੁਣਦੀਆ ਹਨ ਜਿਸ ਦੇ ਕਰਕੇ ਉਹਨਾਂ ਦੇ ਕਾਫ਼ੀ ਪੈਸੇ ਵੀ ਬਚਦੇ ਹਨ ਅਤੇ ਇਹ ਇੱਕ ਉਹਨਾਂ ਦੀ ਕਲਾ ਹੈ ਜਿਵੇਂ ਕਿ ਅਸੀਂ ਮੂਰਤੀ ਕਲਾ ਨੂੰ ਲੈ ਸਕਦੇ ਹਾਂ ਮੂਰਤੀ ਕਲਾ ਇੱਕ ਇਨਸਾਨ ਦੀ ਕਲਾ ਹੁੰਦੀ ਹੈ ਜਿਸ ਦੇ ਵਿੱਚ ਉਹ ਆਪਣੇ ਜੋ ਜਿਸ ਦੇ ਨਾਲ ਉਹ ਮੂਰਤੀ ਬਣਾਉਂਦਾ ਹੈ ਅਤੇ ਉਸ ਨੂੰ ਵੇਚਦਾ ਹੈ ਜਿਸ ਦੇ ਨਾਲ ਉਸ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਢੰਗ ਦੇ ਨਾਲ ਚੱਲਦਾ ਹੈ ਅਤੇ ਇਸ ਦੇ ਇਸ ਤਰ੍ਹਾਂ ਇਹ ਉਸਦਾ ਪਰਸਨਲ ਬਿਜਨਸ ਹੁੰਦਾ ਹੈ ਜਿਸ ਦੇ ਵਿੱਚ ਉਹ ਮੂਰਤੀ ਬਣਾ ਕੇ ਵੇਚਦਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਕਈ ਕਲਾਵਾਂ ਇਹੋ ਜਿਹੀਆਂ ਵੀ ਹਨ ਜਿਹੜੀਆਂ ਕਿ ਅਸੀਂ ਬਾਹਰਲੇ ਦੇਸ਼ਾਂ ਤੋਂ ਸਿੱਖਦੇ ਹਨ ਸਿੱਖਦੇ ਹਾਂ ਅਤੇ ਆਪਣੇ ਦੇਸ਼ ਦੇ ਵਿੱਚ ਕਰਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਮੁੰਡੇ ਟੈਟੂਸ ਵਗੈਰਾ ਬਣਾਉਂਦੇ ਹਨ ਜਿਹੜੇ ਕਿ ਇੱਕ ਬਾਹਰਲੇ ਦੇਸ਼ਾਂ ਤੋਂ ਸਿੱਖ ਕੇ ਆਉਂਦੇ ਹਨ ਅਤੇ ਇੱਥੇ ਆ ਕੇ ਜ਼ਿਆਦਾ ਪੈਸਾ ਕਮਾਉਂਦੇ ਹਨ ਇਹ ਉਹਨਾਂ ਦੀ ਕਲਾ ਹੈ ਕਿ ਉਹ ਟੈਟੂ ਬਣਾਉਂਦੇ ਹਨ ਅਤੇ ਪੈਸਾ ਕਮਾਉਂਦੇ ਹਨ ਅੱਜ ਕੱਲ੍ਹ ਵੈਸੇ ਵੀ ਬੇਰੁਜ਼ਗਾਰੀ ਕਾਫ਼ੀ ਵੱਧ ਗਈ ਹੈ ਜਿਸ ਕਰਕੇ ਹਰ ਕੋਈ ਆਪਣਾ ਬਿਜਨਸ ਕਰਨਾ ਚਾਹੁੰਦਾ ਹੈ ਅਤੇ ਇਸ ਦੇ ਵਿੱਚ ਉਹਨਾਂ ਨੂੰ ਕੋਈ ਘਾਟਾ ਨਹੀਂ ਹੁੰਦਾ ਕਿਉਂਕਿ ਇਹ ਅੱਜ ਕੱਲ੍ਹ ਸਾਰੇ ਹੀ ਕਰ ਰਹੇ ਹਨ ਇਸ ਦੇ ਵਿੱਚ ਉਹਨਾਂ ਨੂੰ ਕਾਫ਼ੀ ਜ਼ਿਆਦਾ ਫ਼ਾਇਦਾ ਹੁੰਦਾ ਹੈ ਅਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਕਈ ਮੁੰਡੇ ਟੈਟੂਸ ਵਗੈਰਾ ਬਣਾਉਂਦੇ ਹਨ ਜਿਹੜੇ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਉਹ ਲੋਕਾਂ ਨੂੰ ਦਿਖਾਉਂਦੇ ਹਨ ਕਿ ਬਈ ਅਸੀਂ ਟੈਟੂ ਬਣਾਏ ਹਨ ਅਤੇ ਲੋਕਾਂ ਨੂੰ ਬਾਹਰੀ ਦਿਖਾਵਾ ਕਰਕੇ ਦਿਖਾਉਂਦੇ ਹਨ ਅਤੇ ਇਹ ਕਲਾ ਬਾਹਰਲੇ ਦੇਸ਼ਾਂ ਤੋਂ ਚੱਲੀ ਹੋਈ ਕਲਾ ਹੈ ਜਿਨ੍ਹਾਂ ਨੂੰ ਕਿ ਸਾਡੇ ਸਮਾਜ ਦੇ ਵਿੱਚ ਕੀਤਾ ਜਾ ਰਿਹਾ ਹੈ ਅਤੇ ਸਾਡੀਆਂ ਪੁਰਾਣੀਆਂ ਕਲਾਵਾਂ ਜਿਵੇਂ ਕਿ ਮੂਰਤੀ ਕਲਾ ਅਤੇ ਸਵੈਟਰ ਸਵੈਟਰ ਬੁਣਨਾ ਅਤੇ ਕਢਾਈ ਕੱਢਣਾ ਇਹ ਪੁਰਾਣੇ ਜ਼ਮਾਨੇ ਤੋਂ ਚਲੀਆਂ ਆ ਰਹੀਆਂ ਪਰਥਾਵਾਂ ਹਨ ਜਿਹੜੀਆਂ ਕਿ ਅੱਜ ਦੇ ਟਾਈਮ ਵਿੱਚ ਵੀ ਕਾਫ਼ੀ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰ ਰਹੀਆਂ ਹਨ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਵੀ ਹਨ ਅਤੇ ਇਸ ਦੇ ਨਾਲ ਸਾਨੂੰ ਕਾਫ਼ੀ ਗਿਆਨ ਹਾਸਲ ਹੁੰਦਾ ਹੈ ਅਤੇ ਸਾਨੂੰ ਕਾਫ਼ੀ ਪੈਸਾ ਵੀ ਮਿਲਦਾ ਹੈ